ਜਾਨਵਰ ਨਾਲ ਮੇਰਾ ਇੱਕ ਅਨੋਖਾ ਹੀ ਰਿਸ਼ਤਾ ਹੈ ਜਿਸਨੂੰ ਮਤਲਬ ਕਿ ਅਲੱਗ ਅਲੱਗ ਤਰ੍ਹਾਂ ਦੇ ਜਾਨਵਰ ਮੈਨੂੰ ਰੱਖਣਾ ਜਾਂ ਉਨ੍ਹਾਂ ਨਾਲ ਟਾਈਮ ਸਪੈਂਡ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਇਸ ਦੌਰਾਨ ਮੈਂ ਇੱਕ ਆਪਣੇ ਘਰ ਵਿੱਚ ਇੱਕ ਡੋਗ ਰੱਖਿਆ ਹੋਇਆ ਹੈ ਉਸਦਾ ਨਾਮ ਹੈ ਜਿੰਮੀ ਅਤੇ ਉਸ ਉਸਦੀ ਮੈਂ ਦੇਖਭਾਲ ਆਪਣੇ ਬੱਚਿਆਂ ਵਾਂਗੂੰ ਕਰਦਾ ਹਾਂ ਡੇਲੀ ਉਸਨੂੰ ਨਹਾਉਂਦਾ ਹਾਂ ਧੁਆਉਂਦਾ ਹਾਂ ਟਾਈਮ ਟੂ ਟਾਈਮ ਵੈਕਸੀਨੇਸ਼ਨ ਲਗਵਾਈ ਦੀ ਹੈ ਉਸਨੂੰ ਉਹ ਆਪਣੇ ਮੇਰੇ ਨਾਲ ਹੀ ਸੌਂਦਾ ਹੈ ਉਸ ਨੂੰ ਵਧੀਆ ਤੋਂ ਵਧੀਆ ਖਾਣਾ ਦਿੰਦਾ ਹਾਂ ਪਿਓਰ ਵੇਜੀਟੇਰੀਅਨ ਹੈ ਉਹ ਤੇ ਅਤੇ ਉਸਦਾ ਮਤਲਬ ਸੁਭਾਅ ਵੀ ਸਾਰੇ ਸਾਰੇ ਆਪਣੇ ਫੈਮਿਲੀ ਮੈਂਬਰਸ ਨਾਲ ਵਧੀਆ ਹੈ ਅਤੇ ਇਸਦਾ ਇਸਦਾ ਇਸਨੂੰ ਲੈ ਕੇ ਪਰਿਵਾਰ ਦੇ ਨਾਲ ਮਤਲਬ ਹਰ ਕਿਸੇ ਨਾਲ ਉਹ ਬਹੁਤ ਵਧੀਆ ਤਰ੍ਹਾਂ ਦਾ ਰਹਿੰਦਾ ਹੈ ਬਾਕੀ ਹੋਰ ਤਰ੍ਹਾਂ ਦੇ ਜਾਨਵਰ ਜਿਸ ਤਰ੍ਹਾਂ ਕਿ ਆਪਣੇ ਤੋਤਾ ਹੋ ਗਿਆ ਆਪਣੇ ਉਹ ਕਬੂਤਰ ਹੋ ਗਏ ਇਸ ਤਰ੍ਹਾਂ ਦੇ ਵੀ ਮੈਂ ਜਾਨਵਰ ਰੱਖੇ ਹੋਏ ਸੀ ਬੱਟ ਹੁਣ ਬਸ ਮੇਰੇ ਕੋਲ ਇੱਕ ਇਕੱਲਾ ਡੋਗ ਹੈ ਜਿਸ ਨਾਲ ਮੈਂ ਆਪਣਾ ਟਾਈਮ ਸਪੈਂਡ ਜ਼ਿਆਦਾ ਕਰਨਾ ਵਧੀਆ ਲੱਗਦਾ ਹੈ ਅਤੇ ਉਹ ਮੇਰੇ ਨਾਲ ਹੀ ਸੌਂਦਾ ਹੈ ਮੇਰੇ ਨਾਲ ਹੀ ਰਹਿੰਦਾ ਹੈ ਮੇਰੇ ਤੋਂ ਵਗੈਰ ਉਹ ਕਿਤੇ ਬਾਹਰ ਵੀ ਨਹੀਂ ਜਾਂਦਾ ਹੈ ਮੇਰੇ ਨਾਲ ਹੀ ਬਾਹਰ ਜਾਂਦਾ ਹੈ ਘੁੰਮਣ ਫਿਰਨ ਅਤੇ ਉਹ ਕਿਸੇ ਵੀ ਲੋਕ ਨੂੰ ਵੱਢਣ ਜਾਂ ਕੱਟਣ ਵਾਲਾ ਕੋਈ ਸਿਸਟਮ ਨਹੀਂ ਹੈ ਉਸਦਾ ਉਹ ਹਰ ਕਿਸੇ ਨਾਲ ਘੁੱਲ ਮਿਲ ਜਾਂਦਾ ਹੈ ਬੜੀ ਅਸਾਨੀ ਤਰੀਕੇ ਨਾਲ